ਸਕੂਲ ਟਾਈਮ ਦੀ ਗੱਲ ਹੈ ਜਦੋਂ ਸਾਡੀ ਹੋਕੀ ਦੀ ਟੀਮ ਡੀ ਏ ਵੀ ਸਕੂਲ ਰੂਪਨਗਰ ਵਿੱਚ ਖੇਲਣ ਗਏ ਸੀ ਤਾਂ ਉੱਥੇ ਅਸੀਂ ਹੋਕੀ ਦਾ ਮੈਚ ਬਹੁਤ ਵਧੀਆ ਤਰੀਕੇ ਨਾਲ ਖੇਡਿਆ ਅਤੇ ਅਸੀਂ ਇੱਕ ਜ਼ੀਰੋ ਦੇ ਮੁਕਾਬਲੇ ਅੱਗੇ ਸਨ ਪਰ ਸਾਡੇ ਵਿੱਚੋਂ ਇੱਕ ਪਲੇਅਰ ਨੇ ਗਲਤੀ ਨਾਲ ਇਹੋ ਜਿਹੀ ਗਲਤੀ ਕੀਤੀ ਹੈ ਕਿ ਉਸ ਨੇ ਬੋਲ ਅੱਗੇ ਦੂਸਰੇ ਪਲੇਅਰ ਨੂੰ ਦੇ ਦਿੱਤੀ ਜਿਸ ਨਾਲ ਉਸਨੇ ਮਤਲਬ ਬੜੀ ਆਸਾਨੀ ਨਾਲ ਗੋਲ ਕਰ ਲਿਆ ਹੈ ਅਤੇ ਅਸੀਂ ਪਲਾਂਟੀਆਂ ਦੇ ਵਿੱਚ ਹਾਰ ਗਏ